ਸਤਿ ਸ਼੍ਰੀ ਅਕਾਲ ਸਮਾਰਟ ਫੋਨ ਸਾਡੀ ਜ਼ਿੰਦਗੀ ਚ ਬਹੁਤ ਲਾਭ ਨੇ ਸਮਾਰਟ ਫੋਨ ਦੇ ਸਮਾਰਟ ਫੋਨ ਦੇ ਕਾਰਨ ਅਸੀਂ ਬੜਾ ਕੁਛ ਸਮਾਰਟ ਫੋਨ ਸਾਡੇ ਕਾਰਨ ਬੜਾ ਕੁਛ ਮਤਲਬ ਅ ਦਿੰਦਾ ਆ ਜਿੱਦਾਂ ਕਿ ਸਾਨੂੰ ਸਮਾਰਟ ਫੋਨ ਅੱਜ ਕੱਲ੍ਹ ਅਸੀਂ ਬੈਠ ਕੇ ਆਪਣੇ ਘਰ ਬੈਠ ਕੇ ਸਮਾਰਟ ਫੋਨ ਦੇ ਕਾਰਨ ਹੀ ਆਪਣੇ ਕੋਈ ਵੀ ਮਤਲਬ ਚੀਜ਼ ਖਰੀਦ ਸਕਦੇ ਹਾਂ ਕੋਈ ਵੀ ਅ ਕਿਸੇ ਨਾਲ ਮਤਲਬ ਜੇ ਕੋਈ ਬਾਹਰ ਗਿਆ ਆ ਉਹਦੇ ਨਾਲ ਅਸੀਂ ਗੱਲ ਕਰ ਸਕਦੇ ਹਾਂ ਅਤੇ ਪਹਿਲੇ ਪੁਰਾਣੇ ਜ਼ਮਾਨੇ 'ਚ ਮਤਲਬ ਲੈਟਰਸ ਲਿਖਦੇ ਸੀ ਅਤੇ ਹੁਣ ਵਾਲੇ ਜ਼ਮਾਨੇ 'ਚ ਸਮਾਰਟ ਫੋਨਸ ਦੇ ਕਾਰਨ ਅਸੀਂ ਕੁਛ ਵੀ ਮਤਲਬ ਲਿਖ ਸਕਦੇ ਹਾਂ ਅਤੇ ਅ ਕਿਸੇ ਨੂੰ ਭੇਜ ਸਕਦੇ ਹਾਂ ਅਸੀਂ ਸਮਾਰਟ ਫੋਨ ਦੇ ਕਾਰਨ ਉਹ ਘਰ ਬੈਠੇ ਆਨਲਾਈਨ ਸ਼ੋਪਿੰਗ ਕਰ ਸਕਦੇ ਹਾਂ ਅਤੇ ਘਰ ਬੈਠੇ ਸਾ ਅਸੀਂ ਕੁਛ ਖਾਣ ਨੂੰ ਮੰਗਵਾ ਸਕਦੇ ਹਾਂ ਅਤੇ ਸਮਾਰਟ ਫੋਨਸ ਸਾਡੇ ਲਈ ਬਹੁਤ ਜ਼ਰੂਰੀ ਨੇ ਸਮਾਰਟ ਫੋਨਸ ਦੇ ਕਾਰਨ ਅਸੀਂ ਕੋਈ ਕੰਮ ਕਰ ਸਕਦੇ ਹਾਂ ਜਿੱਦਾਂ ਸਕੂਲ ਦਾ ਕੰਮ ਹੋਵੇ ਅਤੇ ਅਸੀਂ ਸਮਾਰਟ ਫੋਨਜ਼ ਸਮਾਰਟ ਫੋਨਜ਼ ਤੋਂ ਯੂਟਿਊਬ ਤੋਂ ਅਸੀਂ ਹੈਲਪ ਲੈ ਸਕਦੇ ਹਾਂ ਉਹਦੇ 'ਚੋਂ ਅਸੀਂ ਕੰਮ ਕਰ ਸਕਦੇ ਹਾਂ ਸਮਾਰਟ ਫੋਨਜ਼ ਸਾਡੇ ਲਈ ਸਾਡੇ ਲਈ ਬਹੁਤ ਜ਼ਰੂਰੀ ਅਸੀਂ ਜ ਕਿਤੇ ਜਾਣਾ ਹੋਵੇ ਗੂਗਲ ਮੈਪ ਕਰਕੇ ਕੱਢ ਕੇ ਕ ਕੱਢ ਕੇ ਅਸੀਂ ਕੁਛ ਵੀ ਕਰ ਸਕਦੇ ਹਾਂ ਅਤੇ ਸਾਨੂੰ ਉਹਦਾ ਪਤਾ ਚੱਲ ਜਾਂਦਾ ਕਿ ਅਸੀਂ ਕਿੱਧਰ ਜਾਣਾ ਕਿੱਧਰ ਨਹੀਂ ਇਹਦਾ ਅਸੀਂ ਕਿਸੇ ਕੋਲ ਪੁੱਛ ਕੇ ਜਾਂਦੇ ਸੀ ਪਰ ਹੁਣ ਅ ਗੂਗਲ ਮੈਪ ਸਾਨੂੰ ਬਹੁਤ ਲਾਭ ਦਿੰਦਾ ਹੈ ਅਤੇ ਉਹਦੇ ਕਾਰਨ ਅਸੀਂ ਅਸੀਂ ਕਿਤੇ ਵੀ ਜਾ ਸਕਦੇ ਹਾਂ ਅਤੇ ਅੱਜ ਕੱਲ੍ਹ ਖਾਣ ਲਈ ਖਾਣ ਪੀਣ ਲਈ ਅਸੀਂ ਕੁਛ ਵੀ ਬਾਹਰੋਂ ਮੰਗਵਾ ਸਕਦੇ ਹਾਂ ਅਤੇ ਗੂਗਲ ਬੈਂਕ ਜਿੱਦਾਂ ਅਸੀਂ ਕ ਅ ਕਿਸੇ ਨੂੰ ਮਤਲਬ ਪੈਸੇ ਦੇਣੇ ਆ ਅਸੀਂ ਗੂਗਲ ਪੇ ਕਰ ਸਕਦੇ ਹਾਂ ਸਮਾਰਟ ਫੋਨਜ਼ ਦੇ ਕਾਰਨ